ਸ਼ੋਸ਼ਲ ਮੀਡੀਆ ਪਲੈਟਫੋਰਮਾਂ ਦੇ ਵਿੱਚ ਯੂਟਿਊਬਾਂ 'ਤੇ ਵੀ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਹੁੰਦੀਆਂ ਹਨ ਜਿਹਨਾਂ ਤੋਂ ਘਰ ਬੈਠੇ ਔਰਤਾਂ ਬਹੁਤ ਕੁਝ ਸਿੱਖ ਸਕਦੀਆਂਂ ਹਨ ਅਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਜਿਵੇਂ ਕਿ ਯੂਟਿਊਬ ਦੇ ਵਿੱਚ ਕੂਕਿੰਗ ਨਾਲ ਰਿਲੇਟਿਡ ਬਹੁਤ ਕੁਝ ਉੱਥੇ ਪਾਇਆ ਹੁੰਦਾ ਹੈ ਅਤੇ ਔਰਤਾਂ ਵੱਧ ਤੋਂ ਵੱਧ ਉਸਨੂੰ ਸਿੱਖ ਕੇ ਉਸਨੂੰ ਆਪਣੇ ਜੀਵਨ ਦੇ ਵਿੱਚ ਅਜਮਾਉਂਦੀਆਂ ਹਨ ਉਸ ਤੋਂ ਬਿਨਾਂ ਕੱਪੜੇ ਸਿਉਣ ਦਾ ਵੀ ਹਰ ਇੱਕ ਢੰਗ ਅਤੇ ਨੁਕਤਾ ਦਿੱਤਾ ਹੁੰਦਾ ਆ ਜਿਹਨਾਂ ਨੂੰ ਦੇਖ ਕੇ ਔਰਤਾਂ ਉਤਸ਼ਾਹਿਤ ਹੁੰਦੀਆਂ ਹੈ ਅਤੇ ਆਪਣਾ ਵੱਧ ਤੋਂ ਵੱਧ ਕੰਮ ਕਰਦੀਆਂ ਹੈ ਅਤੇ ਉਹਨਾਂ ਦੇ ਵਿੱਚ ਇੱਕ ਅਨੁਭਵ ਪੈਦਾ ਹੁੰਦਾ ਆ ਅਤੇ ਇਸ ਤੋਂ ਬਿਨਾਂ ਪੇਂਟਿੰਗ ਹੁੰਦੀ ਹੈ ਅਤੇ ਪੇਂਟਿੰਗ ਨੂੰ ਦੇਖ ਕੇ ਬੱਚੀਆਂ ਦੇ ਵਿੱਚ ਕਲਾ ਦਾ ਵਿਕਾਸ ਹੁੰਦਾ ਆ ਅਤੇ ਬੱਚੇ ਉਸ ਤੋਂ ਬਹੁਤ ਕੁਝ ਸਿੱਖ ਸਕਦੇ ਹਨ ਅਤੇ ਦੇਖ ਸਕਦੇ ਹਨ